ਮੈਂ ਨਵਾਂਸ਼ਹਿਰ ਦੀ ਰਹਿਣ ਵਾਲੀ ਹਾਂ ਪਹਿਲੇ ਪਹਿਲੇ ਜ਼ਮਾਨੇ ਵਿੱਚ ਤਾਂ ਘਰ ਬਹੁਤ ਹੀ ਕੱਚੇ ਹੁੰਦੇ ਸਨ ਲੋਕ ਲੀ ਲਿਪਾਈ ਕਰਦੇ ਮਿੱਟੀ ਨਾਲ਼ ਲਿਪਾਈ ਕਰਦੇ ਹੁੰਦੇ ਸਨ ਤਾਂ ਉਹ ਜਿਵੇਂ ਜਲੇਬੀ ਦਾ ਰੰਗ ਹੋ ਗਿਆ ਜਲੇਬੀ ਦਾ ਰੰਗ ਹੋ ਗਿਆ ਲੱਡੂ ਦਾ ਰੰਗ ਹੋ ਗਿਆ ਸੰਧੂਰ ਦਾ ਰੰਗ ਹੋ ਗਿਆ ਉਸ ਨਾਲ਼ ਲੋਕ ਡਿਜ਼ਾਇਨ ਬਣਾਉਂਦੇ ਹੁੰਦੇ ਸੀ ਫੁੱਲ ਬੂਟੀਆਂ ਬਣਾਉਂਦੇ ਹੁੰਦੇ ਸੀ ਉਹਨਾਂ ਰੰਗਾਂ ਨਾਲ਼ ਹੁਣ ਤਾਂ ਅੱਜ ਕੱਲ੍ਹ ਮਕਾਨ ਪੱਕੇ ਹੋ ਗਏ ਹਨ ਪੱਕੇ ਹੋ ਗਏ ਹਨ ਅੱਜ ਕੱਲ੍ਹ ਤਾਂ ਲੋਕ ਬਹੁਤ ਹੀ ਪਲਾਸਟਿਕਾਂ ਦੇ ਫੁੱਲ ਬੂਟੇ ਲਗਾਉਂਦੇ ਹਨ ਜਿਸ ਨਾਲ਼ ਸ ਇਹ ਪਲਾਸਟਿਕ ਸੜ ਕੇ ਵਾਤਾਵਰਨ ਨੂੰ ਬਹੁਤ ਹੀ ਨੁਕਸਾਨ ਹੁੰਦਾ ਹੈ ਪਹਿਲਾਂ ਜ਼ਮਾਨੇ ਵਿੱਚ ਤਾਂ ਮਿੱਟੀ ਨਾਲ਼ ਹੀ ਲਿਪਾਈ ਕਰਦੇ ਸੀ ਜਿਸ ਨਾਲ਼ ਵਾਤਾਵਰਨ ਵੀ ਕੋਈ ਨੁਕਸਾਨ ਨਹੀਂ ਸੀ ਹੁੰਦਾ ਇਸ ਵਾਰ ਤਾਂ ਪਲਾਸਟਿਕ ਦੇ ਸੜਨ ਨਾਲ਼ ਵਾਤਾਵਰਨ ਵੀ ਬਹੁਤ ਹੀ ਨੁਕਸਾਨ ਹੁੰਦਾ ਹੈ